ਕੁਝ ਕੁ ਦਿਨ ਪਹਿਲਾਂ ਮੈਨੇ ਐਮਜੋਨ ਤੋਂ ਇੱਕ ਪ੍ਰੋਡਕਟ ਖਰੀਦਿਆ ਸੀ ਜਿਸਦਾ ਕਿ ਰਿਵਿਊ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਮੈਨੇ ਕੁਛ ਕੁ ਦਿਨ ਟਾਈਮ ਪਹਿਲਾਂ ਇੱਕ ਕਰੋਕਰੀ ਦਾ ਸੈਟ ਐਮਾਜੋਨ ਤੋਂ ਖਰੀਦਿਆ ਸੀ ਜੋ ਕਿ ਬਹੁਤ ਵਧੀਆ ਸੀ ਅਤੇ ਇਹ ਬੱਤੀ ਪੀਸਾਂ ਦਾ ਸੈੱਟ ਸੀ ਜੋ ਕਿ ਮੈਨੂੰ ਵਾਜਿਬ ਰੇਟ 'ਤੇ ਉਪਲੱਬਧ ਹੋਇਆ ਅਤੇ ਇਹਦੇ ਉੱਤੇ ਇੱਕ ਔਫਰ ਚੱਲ ਰਿਹਾ ਸੀ ਹਾਂਜੀ ਅਤੇ ਇਸ ਦਾ ਦਾ ਜੋ ਕਿ ਕਲਰ ਮੈਨੂੰ ਸਭ ਤੋਂ ਪਿਆਰਾ ਲੱਗਿਆ ਇਸਦੇ ਜੋ ਕਿ ਡਿਜ਼ਾਈਨ ਸੀ ਸਭ ਤੋਂ ਅਲੱਗ ਸੀ ਇਸ ਵਿੱਚ ਜੋ ਕਿ ਖਾਣਾ ਬਹੁਤ ਹੀ ਸੁੰਦਰ ਲੱਗਦਾ ਇਹਦੇ ਕਰੋਕਰੀ ਸੈੱਟ ਦੇ ਨਾਲ ਸਾਡੇ ਕਿਚਨ ਵਿੱਚ ਚਾਰ ਚੰਦ ਲੱਗ ਗਏ ਨੇ ਅਤੇ ਇਸ ਦੇ ਨਾ ਵਿੱਚ ਜੋ ਕਿ ਹੈ ਖਾਣਾ ਗਰਮ ਰਹਿੰਦਾ ਹੈ ਅਤੇ ਖਾਣੇ ਨੂੰ ਦੇਖ ਕੇ ਖਾਣਾ ਨੂੰ ਖਾਣ ਦੀ ਰੂਹ ਕਰਦੀ ਹੈ ਕਿ ਦੇਖਣ ਨੂੰ ਇੰਨਾ ਸੁੰਦਰ ਲੱਗਦਾ ਇਹਦੇ ਵਿੱਚ ਹੋਰ ਵੀ ਕਈ ਕਲਰ ਸੀਗੇ ਬਟ ਇਹਦਾ ਜੋ ਕਿ ਸ ਚਿੱਟਾ ਰੰਗ ਕਰੋਕਰੀ ਦਾ ਮੈਨੂੰ ਬਹੁਤ ਵਧੀਆ ਲੱਗਿਆ ਇਹਦੀ ਕੁਆਲਿਟੀ ਸਾਰੇ ਹੋਰ ਬਰਤਨਾਂ ਨਾਲੋਂ ਬਹੁਤ ਵਧੀਆ ਹੈ ਇਹ ਕ੍ਰੋਕਰੀ ਸੈੱਟ ਦੀ ਕੁਆਲਿਟੀ ਬਹੁਤ ਹੀ ਬਹੁਤ ਵਧੀਆ ਹੈ ਅਤੇ ਧੰਨਵਾਦ